ਬੋਲੀਵੁੱਡ ਇੰਡਸਟਰੀ ਅੱਜ ਕੱਲ੍ਹ ਸਾਡੀ ਬਹੁਤ ਅੱਗੇ ਵਧ ਰਹੀ ਹੈ ਬੋਲੀਵੁੱਡ ਹੋ ਗਿਆ ਇੰਟਰਨੈਸ਼ਨਲ ਹੋਲੀਵੁੱਡ ਹੋ ਗਏ ਵਰਗੇ ਹਰ ਇੱਕ ਜਗ੍ਹਾ 'ਤੇ ਪੰਜਾਬੀ ਇੰਡਸਟਰੀ ਦੀ ਕੰਮ ਹੋ ਰਹੇ ਨੇ ਵਿਆਹ ਸ਼ਾਦੀ ਹਰ ਇੱਕ ਤਰੀਕੇ ਦੇ ਵਿੱਚ ਪੰਜਾਬੀ ਇੰਡਸਟਰੀ ਇੰਨਵੋਲਵ ਹੋ ਰਹੀ ਹੈ ਜਿੱਥੇ ਕਿ ਸਾਡੇ ਫਾਈਨੈਂਸ਼ਲੀ ਗ੍ਰੋਥ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਇੰਡਸਟਰੀ ਦੀ ਹੋ ਰਹੀ ਹੈ ਜਿੱਥੇ ਸਾਡੇ ਗਾਣੇ ਬਹੁਤ ਮਸ਼ਹੂਰ ਹਨ ਨਹੀਂ ਵਿਆਹ ਸ਼ਾਦੀ ਹੋ ਗਈ ਕੋਈ ਵੀ ਫੰਕਸ਼ਨ ਹੋ ਜਾਵੇ ਉੱਥੇ ਇਹ ਸਾਡੇ ਪੰਜਾਬੀ ਗਾਣਿਆ ਨੇ ਅੱਤ ਕੀਤੀ ਆ ਇਹਦੀ ਕੀਤੀ ਆ ਉੱਥੇ ਆਪਾਂ ਸਾਰੇ ਕਹਿੰਦੇ ਹਾਂ ਕਿ ਇਹ ਗਾਣਾ ਉਹ ਗਾਣਾ ਸਾਰੇ ਗਾਣਿਆਂ ਨੇ ਤਾਂ ਤਲ ਪਾਈ ਦੀ ਹੈ ਜਿੱਥੇ ਕਿ ਸਾਡੇ ਦਿਲਜੀਤ ਦੋਸਾਂਝ ਇੰਟਰਨੈਸ਼ਨਲ ਆਰਟਿਸਟ ਬਣ ਚੁੱਕੇ ਨੇ ਜਿੰਨ੍ਹਾਂ ਨੇ ਹਰ ਇੱਕ ਕੰਟਰੀ ਦੇ ਵਿੱਚ ਜਾ ਕੇ ਆਪਣੇ ਕੋਨਸਰਟ ਲਾ ਕੇ ਪੰਜਾਬੀ ਇੰਡਸਟਰੀ ਨੂੰ ਅੱਗੇ ਵਧਾਇਆ ਹੈ ਉੱਥੋਂ ਦੀ ਸਾਡੇ ਬੋਲੀਵੁੱਡ ਇੰਡਸਟਰੀ ਵਾਲੇ ਵੀ ਅੱਜ ਕੱਲ੍ਹ ਤਾਂ ਪੰਜ ਪੰਜਾਬੀ ਇੰਡਸਟਰੀ ਦੇ ਗਾਣੇ ਚੱਕ ਚੱਕ ਰੀਮੇਕ ਬਣਾ ਰਹੇ ਹਨ ਜਿੱਦਾਂ ਕਿ ਲੀਗਲ ਇਲਲੀਗਲ ਵੈਪਰ ਵਰਗੇ ਗਾਣੇ ਹੋ ਗਏ ਸਿਪ ਸਿਪ ਵਰਗੇ ਗਾਣੇ ਹੋ ਗਏ ਪੰਜਾਬੀ ਇੰਡਸਟਰੀ ਨੇ ਤਾਂ ਹਰ ਇੱਕ ਤਰੀਕੇ ਦੇ ਲੋਕਾਂ ਵਾਸਤੇ ਰਾਹ ਖੋਲ੍ਹ ਛੱਡੇ ਨੇ ਜਿੱਦਾਂ ਕਿ ਗੁਰੂ ਰੰਧਾਵਾ ਸਾਡੇ ਪੰਜਾਬੀ ਇੰਡਸਟਰੀ 'ਚ ਹੀ ਹੁਣ ਅੱਜ ਉਹ ਬੋਲੀਵੁੱਡ ਇੰਡਸਟਰੀ 'ਚ ਜਾ ਕੇ ਆਪਣਾ ਨਾਮ ਬਣਾ ਰਹੇ ਨੇ ਇੰਡਸਟਰੀ ਹਰ ਇੱਕ ਇੰਡਸਟਰੀ ਦੇ ਲੋਕ ਇਸ ਚੀਜ਼ ਨੂੰ ਪ੍ਰੋਪ ਚੰਗੇ ਤਰੀਕੇ ਨਾਲ ਦੇਖ ਰਹੇ ਨੇ ਫਾਈਨੈਂਸ਼ਅਲੀ ਗਰੋ ਹੋ ਰਹੇ ਨੇ